ਸਾਡੀ ਜ਼ਿੰਦਗੀ ਵਿੱਚ ਅਲੱਗ ਅਲੱਗ ਤਿਉਹਾਰਾਂ ਦਾ ਅਲੱਗ ਅਲੱਗ ਮਤਲਬ ਹੈ ਧਾਰਮਿਕ ਤਿਉਹਾਰ ਲੋਕਾਂ ਨੂੰ ਅਧਿਆਤਮਿਕ ਮੁੱਲਾਂ ਦੀ ਯਾਦ ਦਿਲਾਉਂਦੇ ਹਨ ਅਤੇ ਸਾਨੂੰ ਧਾਰਮਿਕ ਕਰਤਵਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕਰਦੇ ਹਨ ਰਾਸ਼ਟਰੀ ਤਿਉਹਾਰ ਕਿਸੀ ਜਾਤੀ ਜਾਂ ਵਿਸ਼ੇਸ਼ ਧਰਮ ਦੇ ਨਹੀਂ ਸਗੋਂ ਪੂਰੇ ਰਾਸ਼ਟਰ ਦਾ ਹੁੰਦਾ ਹੈ ਇਹ ਤਿਉਹਾਰ ਆਪਣੇ ਦੇਸ਼ ਪ੍ਰਤੀ ਪਿਆਰ ਲਈ ਸਾਰਿਆਂ ਨੂੰ ਇੱਕ ਜੁੱਟ ਕਰਦੇ ਹਨ ਸਾਡੇ ਦੇਸ਼ ਵਿੱਚ ਹਰ ਮੌਸਮ ਦੇ ਹਿਸਾਬ ਨਾਲ ਕੁਝ ਤਿਉਹਾਰ ਮਨਾਏ ਜਾਂਦੇ ਹਨ ਹਰ ਖੇਤਰ ਵਿੱਚ ਉਸ ਤਿਉਹਾਰ ਦੇ ਖਾਸ ਪਕਵਾਨ ਬਣਦੇ ਹਨ ਜੋ ਉਸ ਮੌਸਮ ਨਾਲ ਲੜਨ ਲਈ ਸਰੀਰ ਨੂੰ ਤਾਕਤ ਵੀ ਦਿੰਦੇ ਹਨ ਅਤੇ ਸਵਾਦ ਵੀ ਲੋਹੜੀ ਮਾਘੀ ਵਰਗੇ ਤਿਉਹਾਰ ਇਸ ਮੌਸਮ ਵਿੱਚ ਤਿਆਰ ਹੋਣ ਵਾਲੀ ਚੰਗੀ ਫਸਲ ਦੀ ਖੁਸ਼ੀ 'ਚ ਮਨਾਏ ਜਾਂਦੇ ਹਨ ਅੰਤਰਰਾਸ਼ਟਰੀ ਤਿਉਹਾਰ ਅੱਡ ਅੱਡ ਸਮੁਦਾਵਾਂ ਦੀ ਸੰਸਕ੍ਰਿਤੀ ਨਾਚ ਭੋਜਨ ਅਤੇ ਕਲਾਵਾਂ ਦਾ ਅਨੁਭਵ ਇਕੱਠਾ ਦਿੰਦਾ ਹੈ ਇਹਨਾਂ ਤਿਉਹਾਰਾਂ ਨਾਲ ਦੂਸਰੀ ਸੰਸਕ੍ਰਿਤੀ ਵਾਲਿਆਂ ਨਾਲ ਗੱਲਬਾਤ ਕਰਨ ਅਤੇ ਉਸਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਸਾਡੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਵਿੱਚ ਵੀ ਕਈ ਤਿਉਹਾਰ ਮਨਾਏ ਜਾਂਦੇ ਹਨ ਸਾਉਣ ਦੇ ਮਹੀਨੇ ਤੀਜ ਦਾ ਤਿਉਹਾਰ ਮਨਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਇਸਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਸਟੋਲਾਂ ਲਗਾਈਆਂ ਜਾਂਦੀਆਂ ਹਨ ਗਿੱਧੇ ਭੰਗੜੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਅਤੇ ਅਸੀਂ ਵੀ ਤਿਆਰ ਹੋ ਕੇ ਇਹ ਫੰਕਸ਼ਨ ਦੇਖਣ ਜਾਂਦੇ ਹਾਂ ਘਰ ਵਿੱਚ ਅਸੀਂ ਵੀ ਖੀਰ ਪੂੜੇ ਕਚੌਰੀਆਂ ਗੁਲਗੁਲੇ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਖਾਂਦੇ ਹਾਂ ਪੰਦਰਾਂ ਅਗਸਤ ਨੂੰ ਵੀ ਸਕੂਲਾਂ ਵਿੱਚ ਜਸ਼ਨ ਮਨਾਇਆ ਜਾਂਦਾ ਹੈ ਸਕੂਲਾਂ ਵਿੱਚ ਰੰਗਾ ਰੰਗ ਪ੍ਰੋਗਰਾਮ ਹੁੰਦਾ ਹੈ ਬੱਚਿਆਂ ਨੂੰ ਲੱਡੂ ਵੰਡੇ ਜਾਂਦੇ ਹਨ ਅਤੇ ਉਹਨਾਂ ਨੂੰ ਆਜ਼ਾਦੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਛੱਬੀ ਜਨਵਰੀ ਸਕੂਲਾਂ ਵਿੱਚ ਅਤੇ ਸਰਕਾਰੀ ਦਫਤਰਾਂ ਵਿੱਚ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਸਟੇਡੀਅਮ ਵਿੱਚ ਪਰੇਡ ਦਿਖਾਈ ਜਾਂਦੀ ਹੈ ਬੱਚੇ ਤਿਰੰਗੇ ਲੈ ਕੇ ਖੁਸ਼ੀ ਦਾ ਮਾਹੌਲ ਮਹਿਸੂਸ ਕਰਦੇ ਹਨ ਅਤੇ ਦਸੰਬਰ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ ਦਸੰਬਰ ਮਹੀਨੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਇਹ ਨਿੱਕੀਆਂ ਜਿੰਦਾਂ ਦੀ ਕੁਰਬਾਨੀ ਨੂੰ ਯਾਦ ਦਿਲਾਉਂਦਾ ਹੈ ਸਰਕਾਰ ਵੱਲੋਂ ਦਸ ਦਿਨਾਂ ਦੇ ਸੋਗ ਦੀ ਘੋਸ਼ਣਾ ਕੀਤੀ ਗਈ ਹੈ ਜਿਸ ਦੌਰਾਨ ਕੋਈ ਫੰਕਸ਼ਨ ਨਹੀਂ ਕੀਤਾ ਜਾਵੇਗਾ ਇੱਕੀ ਦਸੰਬਰ ਤੋਂ ਲੈ ਕੇ ਇਕੱਤੀ ਦਸੰਬਰ ਤੱਕ ਇਹ ਦਿਨ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕੀਤੇ ਜਾਂਦੇ ਹਨ ਲੋਕ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੇ ਹਨ ਥਾਂ ਥਾਂ ਲੰਗਰ ਲਗਾਏ ਜਾਂਦੇ ਹਨ